ਹਾਂਜੀ ਮੇਰੇ ਸਕੂਲ ਵਿੱਚ ਹਰ ਸਾਲ ਬਾਅਦ ਕਲਾ ਪ੍ਰਦਰਸ਼ਨੀ ਹੁੰਦੀ ਹੈ ਜਿਸ ਵਿੱਚ ਹਰ ਇੱਕ ਕਲਾਸ ਦਾ ਬੱਚਾ ਭਾਗ ਲੈਂਦਾ ਹੈ ਹਰ ਇੱਕ ਬੱਚਾ ਬਹੁਤ ਸੋਹਣੇ ਤਰੀਕੇ ਨਾਲ ਆਪਣਾ ਮੋਡਲ ਤਿਆਰ ਕਰਦਾ ਹੈ ਕੁਛ ਬੱਚੇ ਥਰਮਾਕੋਲ ਦੀ ਮਦਦ ਨਾਲ ਅਤੇ ਕੁਛ ਬੱਚੇ ਆਰਟ ਦੀ ਮਦਦ ਨਾਲ ਆਪਣਾ ਮੋਡਲ ਤਿਆਰ ਕਰਦੇ ਹਨ ਅਤੇ ਉਹਨਾਂ ਦਾ ਮੋਡਲ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਹੈ ਜੋ ਕੁਛ ਮੈਡਮ ਦੇ ਸਮਾ ਸਮਝਾਇਆ ਸਮਝ ਨਹੀਂ ਆਉਂਦਾ ਉਹਨਾਂ ਬੱਚਿਆਂ ਦਾ ਮੋਡਲ ਦੇਖ ਕੇ ਸਮਝ ਆਉਂਦਾ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੋਡਲ ਤਿਆਰ ਕੀਤਾ ਹੁੰਦਾ ਹੈ ਹਰ ਇੱਕ ਬੱਚਾ ਕਿਸੇ ਨਾ ਕਿਸੇ ਨੰਬਰ 'ਤੇ ਆਉਂਦਾ ਹੈ ਕੁਛ ਬੱਚੇ ਪਹਿਲੇ ਨੰਬਰ 'ਤੇ ਆਉਂਦੇ ਹਨ ਕੁਛ ਬੱਚੇ ਦੂਸਰੇ ਨੰਬਰ 'ਤੇ ਆਉਂਦੇ ਹਨ ਅਤੇ ਹਰੇਕ ਬੱਚੇ ਨੂੰ ਕੁਛ ਨਾ ਕੁਛ ਇਨਾਮ ਦਿੱਤਾ ਜਾਂਦਾ ਹੈ ਉਹਨਾਂ ਦਾ ਮੋਡਲ ਦੇਖ ਕੇ ਸੱਚੀ ਹੀ ਬਹੁਤ ਵਧੀਆ ਲੱਗਦਾ ਹੈ ਅਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਉਹਨਾਂ ਦਾ ਮੋਡਲ ਦੇਖ ਕੇ ਇੰਝ ਲੱਗਦਾ ਹੈ ਕਿ ਅਸੀਂ ਵੀ ਕੁਛ ਨਾ ਕੁਛ ਬਣਾਈਏ ਅਤੇ ਕੁਛ ਸਿੱਖੀਏ ਬਹੁਤ ਜ਼ਿਆਦਾ ਸੋਹਣੇ ਤਰੀਕੇ ਨਾਲ ਮੋਡਲ ਬਣਾਇਆ ਹੁੰਦਾ ਹੈ ਬੱਚਿਆਂ ਨੇ ਹਰ ਇੱਕ ਬੱਚ ਕਲਾਸ ਦਾ ਬੱਚਾ ਇਸ ਮੋਡਲ ਵਿ ਇਸ ਪ੍ਰਦਰਸ਼ਨ ਵਿੱਚ ਭਾਗ ਲੈਂਦਾ ਹੈ ਅਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਧੰਨਵਾਦ